ਵਿਗਿਆਨ ਅਤੇ ਤਕਨਾਲੋਜੀ ਨੇ ਬਹੁਤ ਤਰੱਕੀ ਕਰ ਲਈ ਹੈ ਦਿਨ ਪ੍ਰਤੀ ਦਿਨ ਵਿਗਿਆਨ ਅਤੇ ਟੈਕਨੋਲੋਜੀ ਨੇ ਹਰ ਇੱਕ ਗੈਜਟ ਨਵੇਂ ਨਵੇਂ ਨਵੇਂ ਨਵੇਂ ਗੈਜਟ ਕੱਢਣੇ ਸ਼ੁਰੂ ਕਰ ਦਿੱਤੇ ਹਨ ਜਿਵੇਂ ਕਿ ਮੋਬਾਇਲ ਫੋਨ ਮੋਬਾਇਲ ਫੋਨ ਦੀ ਬਹੁਤ ਲੋੜ ਹੋ ਚੁੱਕੀ ਹੈ ਪੰਜਾਬ ਵਿੱਚ ਹਰ ਕਿਸੇ ਕੋਲ ਜਾਂ ਦੁਨੀਆ ਵਿੱਚ ਹਰ ਕਿਸੇ ਕੋਲ ਮੋਬਾਈਲ ਫੋਨ ਹੈਗਾ ਹੀ ਹੈ ਜਿਸ ਕਰਕੇ ਉਹ ਇੱਕ ਸ਼ਹਿਰ ਤੋਂ ਦੂਜੇ ਸ਼ ਸ਼ਹਿਰ ਜਾਂ ਹੋਰ ਕਿਤੇ ਦੂਰ ਸ਼ਹਿਰ ਦੇ ਵਿੱਚ ਫੋਨ ਕਰ ਸਕਦੇ ਹਨ ਜਿਸ ਕਰਕੇ ਉਹਨਾਂ ਨੂੰ ਬਹੁਤ ਇਹ ਚੀਜ਼ ਸੌਖੀ ਹੋ ਚੁੱਕੀ ਹੈ ਗੱਲ ਕਰਨ ਦੇ ਵਿੱਚ ਆਸਾਨੀ ਹੋ ਚੁੱਕੀ ਹੈ ਪਰ ਅੱ ਇਸ ਦੇ ਮਾੜੇ ਪ੍ਰਭਾਵ ਵੀ ਬਹੁਤ ਹਨ ਪੰਜਾਬ ਵਿੱਚ ਬੱਚਾ ਹਰ ਇੱਕ ਬੱਚਾ ਮੋਬਾਇਲ ਫੋਨ ਦੇ ਵਿੱਚ ਇੰਨਾ ਹੀ ਵੜ ਚੁੱਕਿਆ ਹੈ ਕਿ ਉਸ ਨੂੰ ਆਸੇ ਪਾਸੇ ਪਤਾ ਹੀ ਨਹੀਂ ਲੱਗਦਾ ਨਾ ਉਹ ਬੱਚਾ ਖੇਡਦਾ ਹੈ ਨਾ ਹੋਵੇ ਨਾ ਬੱਚਾ ਹੱਸਦਾ ਸਾਰਾ ਦਿਨ ਮੋਬਾਇਲ ਵਿੱਚ ਹੀ ਦੇਖਦਾ ਰਹਿੰਦਾ ਹੈ ਅਤੇ ਵਿਗਿਆਨ ਨੇ ਮੁਬਾਇਲ ਇਸ ਕਰਕੇ ਬਣਾਇਆ ਸੀ ਕਿ ਬੱਚਿਆਂ ਦੀ ਪੜ੍ਹਾਈ ਵਿੱਚ ਵਾਧਾ ਹੋਵੇ ਪਰ ਬੱਚੇ ਤਾਂ ਇਸ ਦਾ ਦੂਰਉਪਯੋਗ ਕਰਦੇ ਹਨ ਜਿਵੇਂ ਕਿ ਮੋਬਾਇਲ ਵਿੱਚ ਗੇਮਾਂ ਖੇਡਦਾ ਰਹਿਣਾ ਸਾਰਾ ਦਿਨ ਪਿਛਲੇ ਸਾਲ ਬੱਚਿਆਂ ਨੇ ਪਬਜੀ ਨਾਮ ਦੀ ਇੱਕ ਗੇਮ ਸੀ ਜੋ ਕਿ ਉਹਨਾਂ ਨੇ ਬਹੁਤ ਖੇਡੀ ਖੇਡੀ ਸੀ ਜਿਸ ਕਰਕੇ ਬੱਚਿਆਂ ਦੀ ਕੁਛ ਬੱਚਿਆਂ ਦੀ ਮੌਤ ਵੀ ਹੋ ਚੁੱਕੀ ਹੋ ਗਈ ਸੀ ਤੇ ਅਤੇ ਉਹਨਾਂ 'ਤੇ ਬਹੁਤ ਮਾੜਾ ਪ੍ਰਭਾਵ ਰਹਿੰਦਾ ਸੀ ਉਹ ਸਾਰਾ ਸਾਰਾ ਦਿਨ ਚਿੜਚਿੜੇ ਰਹਿੰਦੇ ਹੁੰਦੇ ਸੀ ਘਰ ਕੋਈ ਖਾਂਦੇ ਪੀਂਦੇ ਨਹੀਂ ਸੀ ਨਾ ਕਿਸੇ ਦੀ ਗੱਲ ਸੁਣਦੇ ਸੀ ਇੱਦਾਂ ਇਸ ਤਰ੍ਹਾਂ ਚੱਲਦਾ ਰਿਹਾ ਤਾਂ ਇਹ ਇਹ ਬੱਚਿਆਂ ਲਈ ਬਿਲਕੁਲ ਸਹੀ ਨਹੀਂ ਹੈ ਪਹਿਲੇ ਜ਼ਮਾਨੇ ਦੇ ਵਿੱਚ ਬੱਚੇ ਹਰ ਇੱਕ ਪ੍ਰਕਾਰ ਦੀਆਂ ਖੇਡਾਂ ਖੇਡਦੇ ਸਨ ਚਿੜੀ ਛਿੱਕਾ ਆਦਿ ਹੋਰ ਵੀ ਖੇਡਾਂ ਖੇਡਦੇ ਸਨ ਜਿਸ ਕਰਕੇ ਉਹਨਾਂ ਨੂੰ ਕੋਈ ਦਿੱਕਤ ਨਹੀਂ ਆਉਂਦੀ ਸੀ ਉਹਨਾਂ ਦਾ ਸਰੀਰਕ ਮਾਨਸਿਕ ਸਾਰਾ ਕੁਝ ਵਿਕਾਸ ਕਰਦਾ ਸੀ ਖੂਨ ਚੱਲਦਾ ਰਹਿੰਦਾ ਸੀ ਖੂਨ ਅਤੇ ਹੋਰ ਵੀ ਬਹੁਤ ਉਹਨਾਂ ਦੇ ਸਰੀਰ ਦੇ ਵਿੱਚ ਤਬਦੀਲੀਆਂ ਆਉਂਦੀਆਂ ਸੀ ਪਰ ਅੱਜ ਕੱਲ੍ਹ ਦੇ ਬੱਚਿਆਂ ਨੂੰ ਛੋਟੇ ਹੋਣ ਤੋਂ ਹੀ ਬਿਮਾਰੀਆਂ ਲੱਗ ਜਾਂਦੀਆਂ ਹਨ ਨਿਗ੍ਹਾ ਖਰਾਬ ਹੋ ਜਾਂਦੀਆਂ ਹਨ ਮੋਬਾਇਲ ਦੇ ਵਿੱਚ ਜ਼ਿਆਦਾ ਨਿਗ੍ਹਾ ਲਾਉਣਾ ਸਹੀ ਨਹੀਂ ਹੈ ਸਾਨੂੰ ਬਾਹਰ ਵੀ ਖੇਡਣਾ ਚਾਹੀਦਾ ਹੈ ਵਿਗਿਆਨ ਨੇ ਵਿਗਿਆਨ ਨੇ ਆਪਣੇ ਲਈ ਸਹੂਲਤ ਤਾਂ ਬਣਾਈ ਹੈ ਪਰ ਸਾ ਸਾਨੂੰ ਇਸਦਾ ਪ੍ਰਯੋਗ ਘੱਟ ਤੋਂ ਘੱਟ ਕਰਨਾ ਚਾਹੀਦਾ ਹਨ ਸਾਨੂੰ ਇਸ 'ਤੇ ਨਿਰਭਰ ਨਹੀਂ ਰਹਿਣਾ ਚਾਹੀਦਾ ਕਿਉਂਕਿ ਉਹ ਉਹ ਉਹਨਾਂ ਨੇ ਸਾਡੇ ਲਈ ਇਹ ਚੀਜ਼ ਇੱਕ ਵਰਤੋਂ ਲਈ ਬਣਾਈ ਹੈ ਕੰਮ ਦੇ ਲਈ ਨਾ ਕਿ ਇਸ ਇਸ ਨੂੰ ਮਨੋਰੰਜਨ ਲਈ ਮਨੋਰੰਜਨ ਸਾਨੂੰ ਇਸ ਨਾਲ ਨਹੀਂ ਕਰਨਾ ਚਾਹੀਦਾ ਸਾਨੂੰ ਇਸ 'ਤੇ ਪੂਰਾ ਨਿਰਭਰ ਨਹੀਂ ਰਹਿਣਾ ਚਾਹੀਦਾ ਸਾਨੂੰ ਇਸ ਤੋਂ ਘੱਟ ਤੋਂ ਘੱਟ ਇਸ ਦੀ ਵਰਤੋਂ ਲੈਣੀ ਚਾਹੀਦੀ ਹੈ ਅਤੇ ਅਤੇ ਆਪਣਾ ਕੰਮ ਖੁਦ ਕਰਨਾ ਚਾਹੀਦਾ ਹੈ ਪੰ ਪੰਜਾਬ ਦੇ ਵਿੱਚ ਬਹੁਤ ਕਈਆਂ ਨੂੰ ਇਹ ਗੈਜਟ ਨਹੀਂ ਵੀ ਚਲਾਉਣੇ ਆਉਂਦੇ ਜਿਵੇਂ ਕਿ ਉਹਨਾਂ ਨਾਲ ਫਰੋਡ ਅਤੇ ਸਕੈਮ ਵਰਗੀਆਂ ਚੀਜ਼ਾਂ ਹੁੰਦੀਆਂ ਹਨ ਕੁਝ ਉਲਟ ਪੁਲਟ ਨੰਬਰਾਂ ਦੇ ਵਿੱਚੋਂ ਫੋਨ ਆਉਂਦੇ ਹਨ ਅਤੇ ਉਹਨਾਂ ਨੂੰ ਕਹਿੰਦੇ ਹਨ ਵੀ ਤੁਸੀਂ ਡੇਢ ਲੱਖ ਜਾਂ ਇਕ ਲੱਖ ਜਿੱਤ ਚੁੱਕੇ ਹੋ ਅਤੇ ਤੁਸੀਂ ਸਾਨੂੰ ਓ ਟੀ ਪੀ ਵਰਗੀ ਚੀਜ਼ਾਂ ਦਿਓ ਅਤੇ ਉਹ ਓ ਟੀ ਪੀ ਲੈ ਕੇ ਉਹਨਾਂ ਦਾ ਸਾਰਾ ਖਾਤਾ ਖਾਲੀ ਕਰ ਦਿੰਦੇ ਹਨ ਗਰੀਬ ਘਰਾਂ ਦੀ ਔਰਤਾਂ ਜਾਂ ਅਨਪੜ੍ਹ ਲੋਕਾਂ ਨੂੰ ਇਹਨਾਂ ਚੀਜ਼ਾਂ ਬਾਰੇ ਪਤਾ ਨਹੀਂ ਹੁੰਦਾ ਅਤੇ ਉਹ ਇਸ ਗੱਲ ਇਸ ਗੱਲ ਨੂੰ ਦੇਖ ਕੇ ਉਹ ਉਹਨਾਂ ਨੂੰ ਆਪਣਾ ਓ ਟੀ ਪੀ ਦੇ ਦਿੰਦੀਆਂ ਹਨ ਜਿਸ ਕਰਕੇ ਉਹ ਫਿਰ ਬਾਅਦ ਦੇ ਵਿੱਚ ਪਛਤਾਉਦੀਆਂ ਹਨ ਫੋ ਮ ਫੋਨਾਂ ਦੇ ਵਿੱਚ ਇੱਕ ਸਕੈਮਰ ਵੀ ਆ ਚੁੱਕੇ ਹਨ ਫਿਰ ਇੱਕ ਉਹ ਇੱਕ ਜੇ ਆਪਾਂ ਓ ਟੀ ਪੀ ਦੇ ਦਈਏ ਤਾਂ ਉਹ ਆਪਣਾ ਫੋਨ ਹੈਕ ਵੀ ਕਰ ਲੈਂਦੇ ਹਨ ਇਸ ਕਰਕੇ ਸਾਨੂੰ ਜੇ ਆਪਾਂ ਇਸ ਜਿਸ ਕਰਕੇ ਸਾਨੂੰ ਇਹ ਜੇ ਚੰਗੀ ਤਰ੍ਹਾਂ ਗੈਜਟ ਨਹੀਂ ਚਲਾਉਣਾ ਆਉਂਦਾ ਇਹ ਆਪਾਂ ਨੂੰ ਬਹੁਤ ਨੁਕਸਾਨ ਵੀ ਦੇ ਸਕਦਾ ਹੈ ਸਾਨੂੰ ਐਵੇਂ ਐਰੇ ਗੈਰੇ ਨੰਬਰ ਦੇ ਵਿੱਚ ਆਪਣੀ ਕੋਈ ਵੀ ਪ ਪਰਸਨਲ ਜਾਣਕਾਰੀ ਨਹੀਂ ਦੇਣੀ ਚਾਹੀਦੀ ਜਿਸ ਕਰਕੇ ਸਾਨੂੰ ਅੱਗੇ ਜ ਅੱਗੇ ਨੁਕਸਾਨ ਹੋਵੇ ਅਤੇ ਸਾਡੇ ਲਈ ਬਹੁਤ ਵੱਡੀ ਸੂਚਨਾ ਹੈ ਕਿ ਸਾਨੂੰ ਇਸ ਦਾ ਘੱਟ ਤੋਂ ਘੱਟ ਵਰਤੋਂ ਕਰਨੀ ਚਾਹੀਦੀ ਹੈ ਅਤੇ ਇਸ ਦੇ ਇਸ ਨੂੰ ਧਿਆਨ ਨਾਲ ਚਲਾਉਣਾ ਚਾਹੀਦਾ ਹੈ ਅਤੇ ਸਾਵਧਾਨੀ ਨਾਲ ਵਰਤਣਾ ਚਾਹੀਦਾ ਸਾਨੂੰ ਓ ਟੀ ਪੀ ਵਰਗੀਆਂ ਚੀਜ਼ਾਂ ਨੂੰ ਨਿੱਜੀ ਹੀ ਰੱਖਣਾ ਚਾਹੀਦਾ ਅਤੇ ਇਸ ਸਕੈਮਾਂ ਫਰੋਡਾਂ ਤੋਂ ਬਚ ਕੇ ਹੀ ਰਹਿਣਾ ਚਾਹੀਦਾ ਪੜ੍ਹੇ ਲਿਖੇ ਲੋਕ ਇਸ ਤੋਂ ਇਸ ਤੋਂ ਦੂਰ ਰਹਿੰਦੇ ਹਨ ਅਤੇ ਉਹ ਇਹਨਾਂ ਚੀਜ਼ਾਂ 'ਤੇ ਵਿਸ਼ਵਾਸ ਨਹੀਂ ਕਰਦੇ ਅਤੇ ਉਹ ਇਹਨਾਂ ਚੀਜ਼ਾਂ ਦੇ ਬਹਿਕਾਵੇ 'ਚ ਨਹੀਂ ਆਉਂਦੇ ਉਹ ਆਪਾਂ ਨੂੰ ਲਾਲਚ ਦਿੰਦੇ ਹਨ ਜੋ ਕੁਝ ਲੋਕ ਲਾਲਚ ਵਿੱਚ ਆ ਕੇ ਆਪਦਾ ਹੀ ਆਪਦਾ ਹੀ ਨੁਕਸਾਨ ਕਰਵਾ ਲੈਂਦੇ ਹਨ ਪਰ ਪੜ੍ਹੇ ਲੋਕ ਲੋਕ ਇਸ ਚੀਜ਼ਾਂ ਦੇ ਵਿੱਚ ਨਹੀਂ ਆਉਂਦੇ ਅਤੇ ਉਹ ਆਪ ਉਹ ਇਹਨਾਂ ਚੀਜ਼ਾਂ ਨੂੰ ਇਗਨੋਰ ਕਰਕੇ ਇਹਨਾਂ 'ਤੇ ਕੰਪਲੇਂਟ ਕਰਦੇ ਹਨ ਜੋ ਕਿ ਸਹੀ ਹੈ ਸਮਾਜ ਲਈ ਸਹੀ ਹੈ ਪੰਜਾਬ ਦੇ ਵਿੱਚ ਸਾਨੂੰ ਫੋਨ ਮੋਬਾਈਲ ਫੋਨ ਆਦਿ ਹੋਰ ਵੀ ਗੈਜਟ ਘੱਟ ਤੋਂ ਘੱਟ ਵਰਤਣੇ ਚਾਹੀਦੇ ਹਨ ਇਸ 'ਤੇ ਨਿਰਭਰ ਨਹੀਂ ਰਹਿਣਾ ਚਾਹੀਦਾ ਸਗੋਂ ਦੀ ਸਾਰੇ ਕੰਮ ਖੁਦ ਆਪ ਕਰਨੇ ਚਾਹੀਦੇ ਹਨ ਧੰਨਵਾਦ